ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਲੰਬਰ ਸਾਹਿਬ ਮੈਂ ਗੋਰਮੈਂਟ ਸੀਨੀਅਰ ਸੈਕੰਡਰੀ ਸਕੂਲ ਅੰਗਣ ਭੈਣੀ ਤੋਂ ਬੋਲ ਰਿਹਾਂ ਹਾਂਜੀ ਉਹ ਸਾਡੇ ਨਾ ਓਹ ਬਾਥਰੂਮ ਫਲਸ਼ ਦੀਆਂ ਪਾਈਪਾਂ ਜਿਹੀਆਂ ਸੈਟ ਕਰਾਉਣੀਆਂ ਸੀਗੀਆਂ ਲੀਕੇਜ ਹੈਗੀ ਹੈ ਥੋੜ੍ਹੀ ਬਹੁਤ ਹਾਂਜੀ ਜੀ ਇਹ ਭਲਾ ਸਾਨੂੰ ਤਿੰਨ ਚਾਰ ਸਾਲ ਹੋ ਹੀ ਗਏ ਹੈ ਕਰਾਈ ਨੂੰ ਬਸ ਪਾਣੀ ਲੀਕ ਹੋ ਰਿਹਾ ਹੈ ਨਾਲ ਨਲ ਵਿੱਚ ਵੀ ਪਾਣੀ ਰੁਕ ਰੁਕ ਕੇ ਆਉਂਦਾ ਅਤੇ ਕਈ ਪਾਸਿਓ ਲੀਕੇਜ ਦੀਵਾਰਾਂ 'ਚ ਵੀ ਆ ਰਹੀ ਹੈ ਪਾਣੀ ਲੀਕ ਕਰਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਤੁਹਾਨੂੰ ਪਤਾ ਹੋਣਾ ਜੀ ਤੁਸੀਂ ਪਲੰਬਰ ਹੋ ਹਾਂਜੀ ਬਹੁਤ ਸਰ ਹਾਂਜੀ ਦੱਸ ਦਿਓ ਜੀ ਤੁਸੀਂ ਆਪ ਲਿਸਟ ਬਣਾ ਕੇ ਆਪ ਲੈ ਆਇਓ ਜੀ ਸਾਰਾ ਬਿੱਲ ਬੁਲ ਬਣਵਾ ਕੇ ਅਸੀਂ ਤੁਹਾਨੂੰ ਪੇਮੈਂਟ ਕਰਦਾਂਗੇ ਹਾਂਜੀ ਹਾਂਜੀ ਅਤੇ ਤੁਸੀਂ ਕਦੋਂ ਆਓਗੇ ਹਾਂਜੀ ਸਕੂਲ ਓਫ ਹੋਣ ਤੇ ਬੱਚੇ ਫਿਰ ਵਿਛ ਬੋਛ ਰੂਮ ਜਾਣਾ ਹੁੰਦਾ ਨਾ ਫਿਰ ਐਵੇਂ ਦਿੱਕਤ ਆਏ ਹਾਂਜੀ ਸਰ ਠੀਕ ਹੈ ਜੀ ਫਿਰ ਤੁਸੀਂ ਸਾਨੂੰ ਛੁੱਟੀ ਹੁੰਦੀ ਹੈ ਤਿੰਨ ਵਜੇ ਤੋਂ ਬਾਅਦ ਆ ਜਾਇਓ ਕੱਲ੍ਹ ਹਾਂਜੀ ਹਾਂਜੀ ਮੈਂ ਫਿਰ ਉੱਥੇ ਰੋਕਿਆ ਤੁਹਾਨੂੰ ਕੰਮ ਹਾਂਜੀ ਕੰਮ ਕਰਾ ਦਊਗਾ ਤੁਆਨੂੰ ਹਾਂਜੀ ਹਾਂਜੀ ਹਾਂਜੀ ਨਾਲ ਜਾਂ ਫਿਰ ਸਾਡਾ ਪੀਅਨ ਹੈਗਾ ਐ ਸਤਨਾਮ ਉਹ ਤੁਹਾਡੇ ਨਾਲ ਰਹੇਗਾ ਉਹਨੂੰ ਸਾਰਾ ਪਤਾ ਹੈ ਹਾਂਜੀ ਬਾਕੀ ਕੁਛ ਸਮਾਨ ਕੋਲੇਜ ਦਾ ਪੈਪਾਂ ਪੂਪਾਂ ਜਿਹੀਆਂ ਉਹ ਵੀ ਤੁਹਾਨੂੰ ਕਢਵਾ ਕੇ ਦੇ ਦਊਗਾ ਠੀਕ ਓਕੇ ਸਰ ਹਾਂਜੀ ਹਾਂਜੀ ਹਾਂਜੀ ਲੀਕੇਜ ਦੀ ਬਹੁਤ ਪ੍ਰੋਬਲਮ ਆ ਰਹੀ ਸਾਰਾ ਪਾਣੀ ਪਾਣੀ ਹੋ ਜਾਂਦਾ ਬੱਚੇ ਬਹੁਤ ਪ੍ਰੇਸ਼ਾਨ ਹੁੰਦੇ ਐ ਹਾਂਜੀ ਹਾਂਜੀ ਚਲ ਪੈਸੇ ਪੂਸੇ ਦੱਸ ਦਿਓ ਜੀ ਤੁਹਾਡਾ ਕਿੰਨਾ ਖਰਚਾ ਖਰਚਾ ਤੁਹਾਡਾ ਕਿੱਦਾਂ ਦਿਹਾੜੀ ਲਓਗੇ ਅੱਛਾ ਚਲੋ ਜੇ ਠੀਕ ਠੀਕ ਹੈ ਸਰ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਅਤੇ ਹੋਰ ਠੀਕ ਹੈ ਜੀ ਹਾਂਜੀ ਮੈਂ ਹੋਊਂਗਾ ਜਾਂ ਫਿਰ ਪੀਅਨ ਹੋਏਗਾ ਤੁਹਾਡੀ ਗੱਲ ਕਰਾਦਾਂਗੇ ਹੀ ਨੰਬਰ 'ਤੇ ਫੋਨ ਕਰ ਲਿਓ ਜੀ ਹਾਂਜੀ ਹਾਂਜੀ ਸਟਾਫ਼ ਵੋਸ਼ਰੂਮ ਵੀ ਸਾਰੇ ਚੈੱਕ ਕਰ ਲਿਓ ਜੀ ਬੱਚਿਆਂ ਦੇ ਵੀ ਅਤੇ ਸਟਾਫ਼ ਵਾਲੇ ਵੀ ਹਾਂਜੀ ਹਾਂਜੀ ਅਤੇ ਇੱਕ ਹਾਂਜੀ ਹਾਂਜੀ ਅਤੇ ਇੱਕ ਪ੍ਰਿੰਸੀਪਲ ਮੈਮ ਦਾ ਵੀ ਉਹ ਚੈੱਕ ਕਰ ਲਿਓ ਜੀ ਥੋੜ੍ਹਾ ਹਾਂਜੀ ਉਹ ਨਿਊ ਹੀ ਬਣਵਾਇਆ ਸੀਗਾ ਫਿਰ ਵੀ ਥੋੜ੍ਹੀ ਚੈੱਕ ਕਰ ਲਿਓ ਜੀ ਠੀਕ ਧੰਨਵਾਦ ਜੀ ਤੁਹਾਡਾ ਧੰਨਵਾਦ ਓਕੇ ਸਰ ਧੰਨਵਾਦ ਠੀਕ